ਪੰਜਾਬੀ ਸੱਭਿਆਚਾਰ ਵਿੱਚ ਗਹਿਣੇ ਪਾਉਣ ਦਾ ਰਿਵਾਜ਼ ਵੀ ਬੜਾ ਪੁਰਾਤਨ ਹੈ ਬਹੁਤ ਸਮੇਂ ਤੋਂ ਪੰਜਾਬ ਦੇ ਵਿੱਚ ਮੁਟਿਆਰਾਂ ਦੇ ਨਾਲ ਨਾਲ ਗੱਭਰੂ ਵੀ ਕਈ ਪ੍ਰਕਾਰ ਦੇ ਗਹਿਣੇ ਪਾਉਂਦੇ ਹਨ ਉਨ੍ਹਾਂ ਵਿੱਚ ਮੁੱਖ ਤੌਰ 'ਤੇ ਪੰਜਾਬੀ ਗੱਭਰੂਆਂ ਦਾ ਗਹਿਣਾ ਉਹ ਕੈਂਠਾ ਕੈਂਠਾ ਜ਼ਿਆਦਾਤਰ ਉਸ ਸਮੇਂ ਪਇਆ ਜਾਂਦਾ ਹੈ ਜਦੋਂ ਪੰਜਾਬੀ ਨੌਜਵਾਨ ਭੰਗੜੇ ਦੇ ਵਿੱਚ ਜਾਂਦੇ ਹੈ ਜਾਂ ਕਿਸੇ ਵਿਆਹ ਦੇ ਮੌਕੇ ਤਿਆਰ ਹੋਣ ਸਮੇਂ ਵੀ ਕੈਂਠਾ ਜਿਹੜਾ ਪਾਇਆ ਜਾਂਦਾ ਉੱਤੇ ਤਰੀਕੇ ਨਾਲ ਪੰਜਾਬੀ ਮੁਟਿਆਰਾਂ ਦਾ ਮੁੱਖ ਗਹਿਣਾ ਸੱਗੀ ਫ਼ੁੱਲ ਹੈ ਸੱਗੀ ਫ਼ੁੱਲ ਨੂੰ ਵੀ ਮੁਟਿਆਰਾਂ ਗਿੱਧੇ ਦੇ ਵਿੱਚ ਪਾ ਕੇ ਜਾਂਦੀਆਂ ਵਿਆਹਾਂ ਦੇ ਵਿੱਚ ਵੀ ਸੱਗੀ ਫ਼ੁੱਲ ਦੀ ਬਹੁਤ ਮਹੱਤਤਾ ਇਸ ਤੋਂ ਇਲਾਵਾ ਪੰਜਾਬੀ ਮੁਟਿਆਰਾਂ ਲਈ ਜਿਹੜਾ ਨੱਥ ਹੈ ਉਹ ਵਿਆਹ ਸਮੇਂ ਪਾਈ ਜਾਂਦੀ ਹੈ ਟਿੱਕਾ ਵੀ ਨ ਵਿਆਹ ਸਮੇਂ ਲਾਇਆ ਜਾਂਦਾ ਵੰਗਾਂ ਗਜਰੇ ਵਾਲੀਆਂ ਨੱਤੀਆਂ ਹੋਰ ਬਹੁਤ ਪ੍ਰਕਾਰ ਦੇ ਜਿਹੜੇ ਗਹਿਣੇ ਆ ਉਹ ਪੰਜਾਬੀ ਮੁਟਿਆਰਾਂ ਦੁਆਰਾ ਪਾਏ ਜਾਂਦੇ ਆ ਆਪਣੇ ਆਪ ਨੂੰ ਸਜਣ ਲਈ ਸੁਆਰਨ ਲਈ ਪੰਜਾਬ ਦੀਆਂ ਮੁਟਿਆਰਾਂ ਗਹਿਣੇ ਪਾਉਂਦੀਆਂ ਹਨ ਅਤੇ ਪੰਜਾਬ ਦੇ ਗੱਭਰੂ ਵੀ ਕੈਂਠੇ ਗਲਾਂ ਦੇ ਵਿੱਚ ਪਾ ਕੇ ਆਪਣੇ ਆਪ ਨੂੰ ਪੰਜਾਬੀ ਗੱਭਰੂ ਵਜੋਂ ਪੇਸ਼ ਕਰਦੇ ਹਨ